ਹੈਲੋ ਸਤਿ ਸ਼੍ਰੀ ਅਕਾਲ ਤੁਸੀਂ ਪਛ ਤੁਸੀਂ ਪਛਾਣਿਆ ਮੈਨੂੰ ਮੈਂ ਪੂਜਾ ਦੀਦੀ ਦੀ ਸਿਸਟਰ ਹਾਂਜੀ ਉਹਨਾਂ ਦਾ ਤਾਂ ਮੈਰਿਜ ਹੋ ਗਈ ਨਾ ਹਾਂਜੀ ਹਾਂਜੀ ਜੋਬ ਵਗੈਰਾ ਤਾਂ ਨਹੀਂ ਕਰਦੇ ਉਹਨਾਂ ਦੀ ਮੈਰਿਜ ਵਗੈਰਾ ਹੋ ਗਈ ਨਹੀਂ ਸ਼ਾਇਦ ਮਿਲ ਜੁਂਗੀ ਉਹ ਟਰਾਈ ਤਾਂ ਹਜੇ ਵੀ ਕਰ ਰਹੇ ਹਾਂ ਪਰ ਉਹਨਾਂ ਦਾ ਵਿਆਹ ਪਹਿਲਾਂ ਹੋ ਗਿਆ ਹਾਂਜੀ ਹਾਂਜੀ ਮੈਂ ਨਾ ਛੇ ਫੇਸ ਕੋਲਜ 'ਚ ਲੱਗਣਾ ਸੀਗਾ ਮੋਹਾਲੀ ਕੋਲ ਹਾਂਜੀ ਅਤੇ ਮੈਂ ਇਵੇਂ ਪੁੱਛਣਾ ਸੀ ਪੁੱਛਣਾ ਸੀਗਾ ਕਿ ਉਨ ਉੱਥੇ ਦਾ ਮੌਸਮ ਵਗੈਰਾ ਕਿਵੇਂ ਦਾ ਠੀਕ ਹੈ ਜੀ ਠੀਕ ਹੈ ਓਕੇ ਓਕੇ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਂ ਬੀ ਏ ਕਰਨੀ ਸੀਗੀ

ਠੀਕ ਹੈ ਜੀ ਠੀਕ ਹੈ ਜੀ ਚਲੋ ਠੀਕ ਹੈ ਚ ਠੀਕ ਹੈ ਜੀ